ਹਾਂਜੀ ਤੁਸੀਂ ਸੂਟਾਂ ਦੀ ਸਿਲਾਈ ਬਾਰੇ ਸਾਨੂੰ ਪੁੱਛਿਆ ਹੈ ਜੀ ਹਾਂਜੀ ਅਸੀਂ ਸੂਟ ਸਾਰੇ ਸਿਓ ਲੈਂਦੇ ਹਨ ਕੁੜਤੇ ਪਜਾਮੇ ਵੀ ਅੱਡੋ ਅੱਡੀ ਵੱਖ ਵੱਖ ਸੂਟਾਂ ਦੇ ਰੇਟ ਹਨ ਮੈਂ ਮੈਂ ਦੂਜੇ ਨਹੀਂ ਸਾਰੇ ਸੂਟਾਂ ਦੀ ਕਟ ਵਰਕ ਸਾਰੇ ਕੁਛ ਕਰ ਲੈਨੀ ਹਾਂ ਇਸ ਕਰਕੇ ਮੈਂ ਅੱਡੋ ਅੱਡੀ ਰੇਟ ਲਾਏ ਹੋਏ ਹਨ ਦੂਜਿਆਂ ਨਹੀਂ ਅਤੇ ਫਿਰ ਮੈਂ ਦੂਜਾ ਨਹੀਂ ਪਾ ਪੈਲਰ ਪਾਰਲਰ ਸਾਰੇ ਪੈਲ ਪਾਲਰ ਸਾਰੇ ਸੂਟਾਂ ਦੀ ਸਿਲਾਈ ਕਰ ਲੈਨੀ ਹਾਂ ਇਸ ਕਰਕੇ ਜੋ ਵੀ ਗਾਹਕ ਆਉਂਦੇ ਹਨ ਮੇਰੇ ਕੋਲ ਕੱਪੜਿਆਂ ਦੇ ਬਹੁਤ ਜ਼ਿਆਦਾ ਹੋ ਜਾਂਦੇ ਹਨ ਇਸ ਕਰਕੇ ਸ਼ਹਿਰ ਦੇ ਵੱਖ ਵੱਖ ਰੇਟ ਹਨ ਸੋ ਸਾਡੇ ਮੁਹੱਲੇ ਵਿੱਚ ਥੋੜ੍ਹੇ ਜਿਹੇ ਘੱਟ ਰੇਟ ਕਰਕੇ ਕਸਟਮਰ ਬਹੁਤ ਆ ਜਾਂਦੇ ਹਨ ਇਸ ਕਰਕੇ ਮੈਂ ਅੱਡੋ ਅੱਡੀ ਰੇਟ ਸੂਟਾਂ ਦੀ ਕੋਈ ਪਾਈਪਿੰਗ ਲਾ ਲਈ ਕੋਈ ਗਲੇ ਚੰਗੇ ਬਣਾ ਲਏ ਉਹ ਉਸ ਕਰਕੇ ਮੈਂ ਅੱਡੋ ਅੱਡੀ ਰੇਟ ਲਾ ਲੈਂਦੀ ਹਾਂ ਸੋ ਤੁਸੀਂ ਜੋ ਵੀ ਕੁਛ ਕਰਵਾਉਣਾ ਹੋਵੇ ਹੋਰ ਮੈਂ ਪਾਈਪਿੰਗ ਵੀ ਦਾ ਵੀ ਅਲੱਗ ਅਲੱਗ ਰੇਟ ਹੈ ਇਸ ਕਰਕੇ ਮੈਂ ਵੱਖ ਵੱਖ ਤਰ੍ਹਾਂ ਦੇ ਡਿਜ਼ਾਇਨ ਬਣਾ ਲੈਨੀ ਹਾਂ ਇਸ ਕਰਕੇ ਗਾਹਕ ਮੇਰੇ ਕੋਲੇ ਬਹੁਤ ਵੱਧ ਤੋਂ ਵੱਧ ਆ ਜਾਂਦੇ ਹਨ ਸੋ ਅੱਗੇ ਦੱਸਣ ਦੀ ਕੋਸ਼ਿਸ਼ ਕਰਨ ਕਸਟਮਰਾਂ ਨੂੰ ਕਹਿੰਨੀ ਹਾਂ ਕਿ ਅੱਗੇ ਦੱਸਣ ਦੀ ਕੋਸ਼ਿਸ਼ ਕਰੋ ਇਸ ਕਰਕੇ ਮੇਰੇ ਕੋਲ ਕੋਈ ਚੰਗੇ ਗਾਹਕ ਵੀ ਆ ਜਾਣ ਹੋਰ